ਹੈਲੋ ਸਰ ਮੈਂ ਹਰਪ੍ਰੀਤ ਕੌਰ ਬੋਲ ਰਹੀ ਆ ਜੀ ਸਰ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਨਾ ਇਥੋਂ ਕੁਝ ਬੁਕ ਇਸ਼ੂ ਕਰਵਾਈਆਂ ਸੀ ਬੁਕਸ ਦੀ ਡੇਟ ਹੁਣ ਜਦੋਂ ਤੁਹਾਨੂੰ ਮੈਂ ਵਾਪਸ ਕਰਨੀ ਆ ਸੀ ਤਾਂ ਉਹ ਡੇਟ ਲੰਘ ਚੁੱਕੀ ਹੈ ਸਰ ਸਰ ਪਲੀਜ਼ ਤੁਸੀਂ ਮੈਨੂੰ ਦੇਖ ਕੇ ਦੱਸ ਸਕਦੇ ਹੋ ਕਿ ਉਹਦਾ ਕਿੰਨਾ ਕਿੰਨਾ ਫਾਈਨ ਹੋਏਗਾ ਇੱਕ ਮੈਂ ਹਾਂਜੀ ਹਾਂਜੀ ਹਾਂਜੀ ਮੇਰੀ ਲਾਈਬ੍ਰੇਰੀ ਦੀ ਆ ਆਈ ਡੀ ਹੈਗੀ ਹੈ ਸਰ ਡਬਲ ਥ੍ਰੀ ਡਬਲ ਫੋਰ ਤੇ ਮੈਂ ਬੀ ਸੀ ਏ ਕਲਾਸ ਕਰਦੀ ਆਂ ਤੇ ਸਰ ਮੇਰੀਆਂ ਸੀ ਦੋ ਬੁੱਕਸ ਸੀ ਇੱਕ ਡਾਟਾ ਸਟਰਕਚਰ ਤੇ ਇੱਕ ਪ੍ਰੋਗਰਾਮਿੰਗ ਸੀ ਦੀ ਸਰ ਮੈਨੂੰ ਜਿਹੜੀ ਸੀਧੀ ਹੈ ਉਹਦਾ ਟਾਈਮ ਤੇ ਸਰ ਹੋ ਗਏ ਥਰਟੀ ਥ੍ਰੀ ਫੋਰ ਡੇਜ਼ ਹੋ ਗਏ ਆ ਸਰ ਐਕਚੁਅਲ ਵਿੱਚ ਇਸ ਟਾਈਮ ਬੁਕਸ ਵੀ ਮੇਰੀਆਂ ਘਰ ਹੀ ਨੇ ਦੂਸਰੀ ਜਗਹਾ ਤੇ ਪਈਆਂ ਹੋਈਆਂ ਨੇ ਤੇ ਮੈਨੂੰ ਐਗਜੈਕਟ ਡੇਟ ਤਾਂ ਨਹੀਂ ਯਾਦ ਪਰ ਮੈਨੂੰ ਇਨਾ ਪਤਾ ਕਿ ਤੀਹ ਤੋਂ ਬੱਤੀ ਦਿਨਾਂ ਦੇ ਵਿੱਚ ਹੋਣੀ ਹੈ ਔਰ ਜੋ ਡਾਟਾ ਸਟਰਕਚਰ ਦੀ ਬੁੱਕ ਹੈ ਸਰ ਉਸਨੂੰ ਡੇਢ ਮਹੀਨੇ ਦੇ ਕਰੀਬ ਹੋ ਗਿਆ ਉਹ ਘੱਟ ਤੋਂ ਘੱਟ ਚਾਲੀ ਕੁ ਦਿਨ ਹੋ ਗਏ ਸਰ ਹਾਂਜੀ ਹਾਂਜੀ ਸਰ ਇਹ ਜੁਰਮਾਨਾ ਤੇ ਬਹੁਤ ਜਿਆਦਾ ਹੋ ਜਾਏਗਾ ਐਕਚੁਅਲ ਵਿੱਚ ਮੇਰੀ ਤਬੀਅਤ ਨਾ ਠੀਕ ਹੋਣ ਦੀ ਵਜਹਾ ਕਰਕੇ ਸਰ ਮੇਰੀਆਂ ਤੁਸੀਂ ਰਿਪੋਰਟਸ ਵੀ ਚੈੱਕ ਕਰ ਸਕਦੇ ਹੋ ਮੈਂ ਮੈਡੀਕਲ ਵੀ ਦਿੱਤਾ ਹੋਇਆ ਕਲਾਸ ਦੇ ਵਿੱਚ ਮੈਨੂੰ ਡੇਂਗੂ ਫੀਵਰ ਹੋ ਗਿਆ ਸੀ ਸਰ ਡੇਂਗੂ ਬੁਖਾਰ ਹੋਣ ਦੀ ਵਜਹਾ ਕਰਕੇ ਸਰ ਮੈਂ ਕਾਲਜ ਨਹੀਂ ਆ ਪਾਈ ਤੇ ਕੋਈ ਹੋਰ ਵੀ ਸਾਥੀ ਮੇਰਾ ਨਾਲ ਦਾ ਮਤਲਬ ਉਹ ਕਿਤਾਬਾਂ ਨਹੀਂ ਪਹੁੰਚਾ ਸਕਿਆ ਇਸ ਲਈ ਸਰ ਤੁਸੀਂ ਜੇ ਮੇਰਾ ਇਹ ਫੀਸ ਮਾਫ ਕਰ ਦਿੱਤੀ ਜਾਵੇ ਤਾਂ ਮੇਰੇ ਤੇ ਪਲੀਜ ਮੇਰਾ ਕੁਝ ਫਾਈਨੈਂਸ਼ਅਲੀ ਮੈਂ ਕਾਲਜ ਦੀ ਵੀ ਫੀਸ ਦੇਣ ਵਾਲੀ ਹੈ ਉਹਦੇ ਚ ਵੀ ਡਿਲੇ ਹੋ ਗਿਆ ਸਰ ਉਧਰੋਂ ਵੀ ਮੈਨੂੰ ਫਾਈਨ ਪੈ ਰਿਹਾ ਤੇ ਉਹਦੇ ਲਈ ਵੀ ਮੈਂ ਲਿਖ ਰਹੀ ਆ ਸਰ ਪਲੀਜ਼ ਤੁਸੀਂ ਵੀ ਮੈਨੂੰ ਮਾਫ ਕਰੋ ਇਹ ਫਾਈਨ ਪਲੀਜ਼ ਤੁਸੀਂ ਤੁਹਾਡੇ ਹੱਥਾਂ ਵਿੱਚ ਹੀ ਹੁੰਦੀ ਹ ਗੱਲ ਤਾਂ ਸਰ

ਹਾਂ ਹਾਂ ਸਰ ਤੁਸੀਂ ਮੇਰਾ ਪਿਛਲਾ ਰਿਕਾਰਡ ਵੀ ਚੈੱਕ ਕਰ ਸਕਦੇ ਹੋ ਕਿ ਰਿਕਾਰਡ ਬਿਲਕੁਲ ਸਹੀ ਨੇ ਸਰ ਇਹਦੇ ਵਿੱਚ ਮੈਂ ਪਹਿਲਾਂ ਆਪਣੀ ਫੀਸ ਵੀ ਮਾਫ ਕਰਵਾ ਚੁੱਕੇ ਆਂ ਤਾਂ ਸ਼ਾਇਦ ਮੈਨੂੰ ਟੀਚਰ ਇਸ ਚੀਜ਼ ਤੇ ਗੁੱਸਾ ਕਰੇ ਸਰ ਤੁਸੀਂ ਪਲੀਜ਼ ਦੇਖ ਸਕਦੇ ਹੋ ਤਾਂ ਮੇਰਾ ਪਿਛਲਾ ਰਿਕਾਰਡ ਤੁਸੀਂ ਪ੍ਰੋਪਰ ਚੈੱਕ ਕਰੋ ਕਿ ਉਹ ਟਾਈਮਲੀ ਮੈਂ ਹਰ ਚੀਜ਼ ਰਿਟਰਨ ਕਰਦੀ ਰਹੀ ਆਂ ਮੈਂ ਇੱਕ ਅੱਛੀ ਸਟੂਡੈਂਟ ਹਾਂ ਆਪਣੇ ਕਾਲਜ ਦੀ ਸਰ ਚਲੋ ਸਰ ਠੀਕ ਹ ਜੀ ਮੈਂ ਕੱਲ ਇੱਕ ਲੈਟਰ ਲਿਖ ਕੇ ਆਪਣੇ ਟੀਚਰ ਤੋਂ ਸਾਈਨ ਕਰਵਾ ਕੇ ਤੁਹਾਨੂੰ ਪ੍ਰੋਵਾਈਡ ਕਰਵਾ ਦਾਗੀ ਥੈਂਕਯੂ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ